ਸਿੰਚਾਈ ਦੇ ਵੈਸੇ ਤਾਂ ਬਹੁਤ ਬਹੁਤ ਸਾਧਨ ਨੇ ਤਰ੍ਹਾਂ ਤਰ੍ਹਾਂ ਦੇ ਸਾਧਨ ਨੇ ਪੁਰਾਣੇ ਟਾਈਮਾਂ ਦੇ ਵਿੱਚ ਜਿਹੜਾ ਸ ਪੁਰਾਣੇ ਟਾਈਮਾਂ ਦੇ ਵਿੱਚ ਸਿੰਚਾਈ ਦਾ ਸਾਧਨ ਸੀਗਾ ਉਹ ਖਾਸ ਕਰਕੇ ਖੂਹਾਂ ਰਾਹੀਂ ਜਾਂ ਜਿਹੜਾ ਨਹਿਰੀ ਪਾਣੀ ਕੱਸੀਆਂ 'ਚ ਆਉਂਦਾ ਸੀ ਉਹਦੇ ਰਾਹੀਂ ਮਿਲਦਾ ਰਿਹਾ ਅਤੇ ਬਰਸਾਤੀ ਪਾਣੀ ਇਕੱਠਾ ਕਰਕੇ ਟੋਭੇ 'ਚ ਕ ਤਲਾਬ 'ਚ ਇਕੱਠਾ ਕਰਕੇ ਉਹਨੂੰ ਵੀ ਪ ਪਾਣੀ ਵਰਤਿਆ ਜਾਂਦਾ ਸੀ ਖੇਤੀ ਲਈ ਅਤੇ ਫਿਰ ਸਰਕਾਰੀ ਇੱਕ ਟਿਊਬਲ ਪਿੰਡ ਵਿੱਚ ਇੱਕ ਟਿਊਬਲ ਲੱਗਦਾ ਸੀ ਜਿਹੜਾ ਵਾਰੀ ਮੁਤਾਬਕ ਸਾਰੇ ਲੋਕਾਂ ਨੂੰ ਉਹ ਤੋਂ ਪਾਣੀ ਵਾਰੀ ਵਾਰੀ ਖੇਤਾਂ ਨੂੰ ਦਿੱਤਾ ਜਾਂਦਾ ਸੀ ਪਰ ਅਜੋਕੇ ਸਮੇਂ 'ਚ ਹੁਣ ਕਈ ਤਰ੍ਹਾਂ ਦੇ ਨਵੇਂ ਸਾਧਨ ਆ ਗਏ ਨੇ ਜਿਨ੍ਹਾਂ 'ਚ ਸਵਰਸੀਬਲ ਸੋਲਰ ਮੋਟਰਾਂ ਤੱਕ ਆ ਗਈਆਂ ਨੇ ਅਤੇ ਜਿਹੜਾ ਪਾਣੀ ਦਾ ਪੱਧਰ ਹੈ ਉਹ ਬਹੁਤ ਜ਼ਿਆਦਾ ਐਨਾ ਘੱਟ ਗਿਆ ਕਿਉਂਕਿ ਹੁਣ ਇਹਦਾ ਨਹਿਰੀ ਪਾਣੀ ਹੈ ਉਹ ਇੱਕ ਸਾਰੇ ਹੋਰ ਸੂਬਿਆਂ ਨੂੰ ਪੰਜਾਬ ਦਾ ਕੱਟ ਕੱਟ ਕੇ ਜਾ ਰਿਹਾ ਜਿਵੇਂ ਰਾਜਸਥਾਨ ਹਰਿਆਣਾ ਅਤੇ ਉਹਦੇ ਬੜੇ ਤਰ੍ਹਾਂ ਦੇ ਅੱਡ ਕ ਕਲੇਸ਼ ਪਾਏ ਹੋਏ ਨੇ ਧਰਮ ਦੇ ਅਧਾਰ 'ਤੇ ਜਾਤੀ ਦੇ ਅਧਾਰ 'ਤੇ ਸੂਬਿਆਂ ਅਧਾਰ 'ਤੇ ਕਈ ਤਰ੍ਹਾਂ ਦਾ ਉਹਦੇ ਨਾਲ ਕਲੇਸ਼ ਵੀ ਖੜ੍ਹਾ ਹੋਇਆ ਇਸ ਕਰਕੇ ਮਹਿੰਗਾਈ ਦਾ ਟਰੈਕਟਰ ਜਿਹੜਾ ਡੀਜ਼ਲ ਬਹੁਤ ਮਹਿੰਗਾ ਉਦੋਂ ਨਾ ਜਨਰੇਟਰ ਰਾਹੀਂ ਵੀ ਅੱਜ ਕੱਲ੍ਹ ਪਾਣੀ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਮਹਿੰਗਾ ਪੈਂਦਾ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਜਿਹੜੀ ਬਿਜਲੀ ਹੈ ਉਹ ਵੱਧ ਤੋਂ ਵੱਧ ਦਿੱਤੀ ਜਾਵੇ ਅਤੇ ਸੋਲਰ ਮੋਟਰਾਂ ਦੀ ਜਿਹੜੀ ਹੈ ਸਬਸਿਡੀ ਵੈਸੇ ਤਾਂ ਸਰਕਾਰ ਦੇ ਰਹੀ ਹੈ ਉਹ ਸਬਸਿਡੀ ਹੋਰ ਦਿੱਤੀ ਜਾਵੇ ਤਾਂ ਕਿ ਲੋਕਾਂ ਨੂੰ ਪਾਣੀ ਦੀ ਵਰਤੋਂ 'ਚ ਸੌਖਾ ਰਹੇ